ਭਾਰਤੀ ਨੌਜਵਾਨ ਬਜ਼ਾਰ ਦੀ ਗੱਲ ਕੀਤੀ ਜਾਵੇ ਤਾਂ ਇਸ ਟਾਈਮ ਇਹਦੀ ਸਥਿਤੀ ਬਹੁਤ ਹੀ ਮਾੜੀ ਆ ਕਿਉਂਕਿ ਲੋਕਾਂ ਨੂੰ ਕੰਮ ਨਹੀਂ ਮਿਲਦਾ ਪਿਆ ਇੱਥੇ ਲੋਕਾਂ ਨੇ ਪੜ੍ਹਾਈ ਬਹੁਤ ਜ਼ਿਆਦਾ ਕਰ ਦਿੱਤੀ ਹੈ ਇੱਕ ਜੇ ਕੰਮ ਮਿਲਦਾ ਵੀ ਆ ਤਾਂ ਸਿਰਫ ਅੱਠ ਨੌਂ ਹਜ਼ਾਰ ਵਾਲਾ ਇਸ ਕਰਕੇ ਲੋਕਾਂ ਦਾ ਕਈਆਂ ਦਾ ਧਿਆਨ ਜ਼ਿਆਦਾਤਰ ਮਤਲਬ ਫਿਰ ਬਾਹਰ ਵੱਲ ਨੂੰ ਜਾਈ ਜਾਂਦਾ ਹੈ ਜਾਂ ਕੁਝ ਲੋਕ ਇੰਨੀਆਂ ਵੱਡੀਆਂ ਵੱਡੀਆਂ ਡਿਗਰੀਆਂ ਕਰਕੇ ਜਦੋਂ ਕੰਮ ਨਹੀਂ ਮਿਲਦਾ ਅਤੇ ਨਸ਼ੇ ਪੱਤੇ ਦਾ ਸੇਵਨ ਕਰਨ ਲੱਗ ਜਾਂਦੇ ਨੇ ਜੋ ਕਿ ਗਲਤ ਗੱਲ ਆ ਹੈ ਸਾਡੀ ਸਰਕਾਰ ਨੂੰ ਚਾਹੀਦਾ ਹੈ ਕਿ ਨੌਜਵਾਨ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣਾ ਚਾਹੀਦਾ ਹੈ ਤਾਂ ਜੋ ਉਹ ਇੱਥੇ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਆਪਣੇ ਦੇਸ਼ ਭਾਰਤ ਦਾ ਨਾਮ ਉੱਚਾ ਕਰ ਸਕਣ ਇੱਥੇ ਕਈ ਕਿਸਾਨ ਵਗੈਰਾ ਵੀ ਨੂੰ ਵੀ ਰੁਜ਼ਗਾਰ ਨਹੀਂ ਮਿਲਦਾ ਉਹ ਵੀ ਮੰਡੀਆਂ ਵਿੱਚ ਧੱਕੇ ਵਗੈਰਾ ਖਾਈ ਖਾਂਦੇ ਪਏ ਹੈਗੇ ਨੇ ਉਹਨਾਂ ਨੂੰ ਵੀ ਪ੍ਰੋਪਰ ਉਹਨਾਂ ਦਾ ਮੁਨਾਫਾ ਦੇਣਾ ਚਾਹੀਦਾ ਹੈ